ਭਾਰਤ ਵਿੱਚ ਡਾਂਸਰਾਂ ਦਾ ਬੋਲੀਵੁੱਡ 'ਤੇ ਬਹੁਤ ਹੀ ਵੱਡਾ ਪ੍ਰਭਾਵ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਦੋਂ ਆਪਾਂ ਵਿਆਹ ਸ਼ਾਦੀ 'ਤੇ ਜਾਂਦੇ ਹਾਂ ਤਾਂ ਉੱਥੇ ਡਾਂਸਰਾਂ ਡਾਂਸ ਕਰਦੀਆਂ ਹਨ ਸਭ ਤੋਂ ਪਹਿਲਾਂ ਉਹ ਆਪਣੀ ਤਿਆਰੀ ਕਰਦੀਆਂ ਹਨ ਸਟੈਪ ਨੂੰ ਪ੍ਰਫੈਕਟ ਤੌਰ 'ਤੇ ਕਰਦੀਆਂ ਹਨ ਵੀਡੀਓ ਦੇ ਅਕੌਰਡਿੰਗ ਕਰਦੀਆਂ ਹਨ ਜਿਵੇਂ ਕਿ ਮੈਂ ਦੇਖਿਆ ਕਿ ਡਾਂਸਰਾ ਸਭ ਤੋਂ ਵੱਧ ਬੋਲੀਵੁੱਡ ਗ ਗਾਣਿਆਂ 'ਤੇ ਡਾਂਸ ਕਰਦੀਆਂ ਹਨ ਜਿਵੇਂ ਕਿ ਉਹ ਹਿੰਦੀ ਸੌਂਗਸ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ ਉਸ ਦੇ ਅਕੌਰਡਿੰਗ ਹੀ ਉਹ ਡਾਂਸ ਵਿੱਚ ਰੁਚੀ ਰੱਖਦੀਆਂ ਹਨ ਕਈ ਤਰ੍ਹਾਂ ਦੇ ਹਿੰਦੀ ਸੌਂਗ ਹਨ ਜਿਵੇਂ ਕਿ ਆਪਾਂ ਜਾਣਦੇ ਹਾਂ ਚਾਰ ਬੋਤਲ ਵੋਡਕਾ ਬਤਮੀਜ਼ ਦਿਲ ਕਭੀ ਖੁਸ਼ੀ ਕਭੀ ਗਮ ਕੱਲ੍ਹ ਹੋ ਨਾ ਹੋ ਉਕਾਬਾਰ ਸ਼ਈਆਂ ਸ਼ਈਆਂ ਦਮ ਮਾਰੋ ਦਮ ਆਦਿ ਹਿੰਦੀ ਸੌਗ ਨੂੰ ਵਿੱਚ ਉਹ ਜ਼ਿਆਦਾਤਰ ਡਾਂਸ ਕਰਦੀਆਂ ਹਨ ਅਤੇ ਉਸਦੇ ਸਟੈਪ ਨੂੰ ਵਾਰ ਵਾਰ ਦੁਹਰਾਉਂਦੀਆਂ ਹਨ ਜਿਸ ਤਰ੍ਹਾਂ ਕਿ ਉਹ ਰੰਗ ਬਿਰੰਗੇ ਕੱਪੜੇ ਪਾ ਕੇ ਉਸ ਤਰ੍ਹਾਂ ਹੀ ਡਾਂਸ ਕਰਦੀਆਂ ਹਨ